ਹੈਲੋ ਹਾਂਜੀ ਨਮਸਕਾਰ ਹਾਂਜੀ ਨਮਸਕਾਰ ਸਰ ਜੀ ਜੀ ਸਰ ਜੀ ਜੀ ਅੱਛਾ ਸਰ ਤੁਸੀਂ ਉਹ ਪਲਾਨ ਦਿਓ ਜਿਹਦੇ 'ਚ ਡਾਟਾ ਜ਼ਿਆਦਾ ਹੋਵੇ ਤਾਂ ਕਿ ਬੱਚੇ ਪੜ੍ਹਦੇ ਹੈ ਹੈ ਨਾ ਅਤੇ ਜਦੋਂ ਬੱਚੇ ਪੜ੍ਹਦੇ ਹੈ ਫਿਰ ਜ਼ਿਆਦਾ ਡਾਟੇ ਦੀ ਲੋੜ ਪੈਂਦੀ ਹੈ ਚਲੋ ਅਸੀਂ ਘਰ ਵਾਲੇ ਹਾਂ ਘਰੇਲੂ ਹੈ ਨਾ ਹੈਗੇ ਹਾਂ ਅਸੀਂ ਅਤੇ ਜਾਂ ਘਰ ਮੇਰੀ ਮਦਰ ਹੁੰਦੇ ਹੈ ਵਿਚਾਰੇ ਉਹ ਹੈ ਨਾ ਜ਼ਿਆਦਾ ਖ਼ਬਰਾਂ ਖੁਬਰਾਂ ਦੇਖਦੇ ਜ਼ਿਆਦਾ ਅਤੇ ਡਾਟਾ ਸਾਨੂੰ ਜ਼ਿਆਦਾ ਚਾਹੀਦਾ ਹੈ ਨੈੱਟਫਲਿਕਸ ਵਗੈਰਾ ਵੀ ਉਹਦੇ 'ਤੇ ਚੱਲ ਪਵੇ ਮੂਵੀ ਮਾਵੀ ਅਸੀਂ ਵੀ ਦੇਖ ਲਈਏ ਮਾੜੀ ਮੋਟੀ ਹੈ ਨਾ ਹਾਂਜੀ ਅਤੇ ਸਰ ਕਿੰਨਾ ਡਾਟਾ ਦਿੰਦੇ ਹੋ ਤੁਸੀਂ ਹਜ਼ਾਰ ਰੁਪਏ ਵਿੱਚ ਕਿੰਨਾ ਸਰ ਡਾਟਾ ਦਿਉਗੇ ਸਾਨੂੰ ਹਾਂਜੀ

ਅਤੇ ਸਰ ਬਿੱਲ ਬੁਲ ਕਿੱਦਾਂ ਆਉਂਦਾ ਹੁੰਦਾ ਨੈੱਟ ਚੱਲਦਾ ਵੀ ਹੈ ਕਿ ਨਾਂ ਦਾ ਹੀ ਨੈੱਟ ਹੈ ਇਹ ਵੀ ਦੱਸ ਦਿਉ ਅੱਛਾ ਅਤੇ ਸਰ ਕਈ ਵਾਰ ਹੁੰਦਾ ਨੈੱਟ ਚੱਲਦਾ ਨਹੀਂ ਪੂਰਾ ਮਹੀਨਾ ਅਤੇ ਬਿੱਲ ਭੇਜ ਦਿੰਦੇ ਹੈ ਹਜ਼ਾਰ ਰੁਪਿਆ ਰੱਖ ਕੇ ਨਾ ਅਗਲੇ

ਠੀਕ ਹੈ ਸਰ ਨੌ ਤੋਂ ਪੰਜ ਅਸੀਂ ਬਾਹਰ ਹੁੰਦੇ ਹਾਂ ਜੀ ਛੇ ਕੁ ਵਜੇ ਤੁਸੀਂ ਆ ਕੇ ਫਿਰ ਲਗਾ ਦਿਓ ਠੀਕ ਹੈ ਜੀ ਠੀਕ ਹੈ ਸਰ ਠੀਕ ਹਾਂਜੀ ਹਾਂਜੀ ਸਰ ਸਰ ਕੋਈ ਇੱਕ ਮੈਂ ਗੱਲ ਹੋਰ ਵੀ ਸਰ ਪੁੱਛਣੀ ਸੀ ਤੁਹਾਨੂੰ ਮੈਂ ਸਰ ਕੋਈ ਐਡਰੈੱਸ ਐਡਰੁਸ ਅਤੇ ਤੁਸੀਂ ਜਦੋਂ ਇੱਦਾਂ ਹੈ ਨਾ ਮੋਹਾਲੀ ਹੈ ਉੱਥੇ ਆ ਕੇ ਭਾਵੇਂ ਕਾਲ ਕਰ ਲਿਉ ਤੁਸੀਂ ਅੰਬ ਸਾਹਿਬ ਗੁਰਦੁਆਰੇ ਦੇ ਲਾਗੇ ਹੈਲੋ ਹਾਂ ਅੰਬ ਸਾਹਿਬ ਗੁਰਦੁਆਰਾ ਸਾਹਿਬ ਦੇ ਲਾਗੇ ਹਾਂਜੀ ਜੀ ਜੀ ਹਾਂਜੀ ਹਾਂਜੀ ਹਾਂਜੀ ਚਲੋ ਸਰ ਠੀਕ ਹੈ ਓਕੇ ਓਕੇ ਥੈਂਕ ਯੂ ਸਰ ਓਕੇ ਓਕੇ ਸਰ